ਬਰਤਨ ਧੋਣ ਦੀ ਪ੍ਰਕਿਰਿਆ ਬਾਰੇ ਜੇਕਰ ਮੈਂ ਤੁਹਾਨੂੰ ਦੱਸਾਂ ਤਾਂ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਮੈਂ ਕਿਸ ਤਰ੍ਹਾਂ ਨਾਲ ਬਰਤਨ ਧੋਂਦਾ ਹਾਂ ਜਾਂ ਬਰਤਨ ਨੂੰ ਸਾਫ ਕਰਦਾ ਹਾਂ ਜੇਕਰ ਗੱਲ ਕੀਤੀ ਜਾਵੇ ਮੇਰੀ ਤਾਂ ਮੈਂ ਬਰਤਨ ਨੂੰ ਸਭ ਤੋਂ ਪਹਿਲਾਂ ਲਿਕੁਇਡ ਸਰਫ ਨਾਲ ਬਰਤਨ 'ਤੇ ਲਗਾਉਂਦਾ ਹਾਂ ਉਸਨੂੰ ਮਲਦਾ ਹੈ ਚੰਗੇ ਤਰੀਕੇ ਨਾਲ ਬਰਤਨ ਉੱਤੇ ਅਤੇ ਉਸ ਤੋਂ ਬਾਅਦ ਮੈਂ ਉਸਨੂੰ ਧੋਂਦਾ ਹਾਂ ਅਤੇ ਜੇਕਰ ਕੋਈ ਦਾਗ ਜਾਂ ਕੁਛ ਰਹਿ ਜਾਵੇ ਤਾਂ ਮੈਂ ਫਿਰ ਤੋਂ ਉਸ ਦੀ ਵਰਤੋਂ ਨਾਲ ਉਸਨੂੰ ਸਾਫ ਕਰਦਾ ਹਾਂ ਅਤੇ ਉਸਨੂੰ ਫਿਰ ਪਾਣੀ ਦੇ ਰਾਹੀਂ ਧੋਂਦਾ ਹਾਂ ਜਿਸ ਨਾਲ ਬਰਤਨ ਚੰਗੇ ਤਰੀਕੇ ਨਾਲ ਸਾਫ ਹੋ ਜਾਂਦਾ ਹੈ ਅਤੇ ਉਸਦੇ ਉੱਤੇ ਲੱਗੇ ਦਾਗ ਵੀ ਨਹੀਂ ਰਹਿੰਦੇ